ਜ਼ਿਆਦਾਤਰ ਮਨੁੱਖ ਉਦੋਂ ਹੀ ਗਾਉਂਦਾ ਹੈ ਜਦੋਂ ਉਹ ਇਕੱਲਾ ਹੁੰਦਾ ਹੈ ਇਸ ਤੋਂ ਇਲਾਵਾ ਉਹ ਸ਼ੌਕ ਵਜੋਂ ਵੀ ਗਾਉਣ ਲੱਗਦਾ ਹੈ ਪਰ ਮੈਂ ਆਪਣੇ ਇਕੱਲੇ ਸਮੇਂ ਵਿੱਚ ਹੀ ਗਾਉਂਦਾ ਹੁੰਦਾ ਸੀ ਨਿੱਕੇ ਹੁੰਦੇ ਤੋਂ ਲੈ ਕੇ ਮੈਨੂੰ ਯਾਦ ਹੈ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਹੁੰਦਾ ਸੀ ਤਾਂ ਮੈਂ ਇੱਕ ਵਾਰ ਸਟੇਜ 'ਤੇ ਗਾਇਆ ਸੀ ਅਤੇ ਉਸ ਸਮੇਂ ਮੈਂ ਘਬਰਾ ਗਿਆ ਸੀ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਆਪਣਾ ਇੱਕ ਗੀਤ ਤਿਆਰ ਕਰਿਆ ਸੀ ਅਤੇ ਮੈਂ ਉਸ ਨੂੰ ਸਟੇਜ ਉੱਤੇ ਗਾਉਣਾ ਚਾਹੁੰਦਾ ਸੀ ਇਹ ਮੇਲਾ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਵੀ ਮੈਂ ਕਿਸੇ ਵੀ ਵੱਡੀ ਸਟੇਜ ਜਾਂ ਬਹੁਤ ਸਾਰੇ ਵਿਅਕਤੀਆਂ ਦੇ ਸਾਹਮਣੇ ਗਾਉਣ ਜਾ ਰਿਹਾ ਸੀਗਾ ਅਤੇ ਜਦੋਂ ਮੈਂ ਗਾਣਾ ਆਪਣਾ ਗਾਉਣਾ ਸਟਾਰਟ ਕੀਤਾ ਤਾਂ ਮੈਂ ਇੱਕ ਦੋ ਲਾਈਨਾਂ ਹੀ ਗਾਈਆਂ ਸੀ ਤਾਂ ਮੈਂ ਜਦੋਂ ਲੋਕਾਂ ਦੇ ਇਕੱਠ ਵੱਲ ਝਾਕਿਆ ਤਾਂ ਇਸ ਇੱਕ ਸੌ ਦੋ ਸੌ ਲੋਕਾਂ ਦਾ ਇਕੱਠ ਸੀ ਅਤੇ ਮੈਂ ਉਸ ਇਕੱਠ ਨੂੰ ਦੇਖ ਕੇ ਘਬਰਾ ਗਿਆ ਕਿਉਂਕਿ ਇਹ ਮੇਰਾ ਫਰਸਟ ਐਕਸਪੀਰੀਅੰਸ ਸੀ ਜਿਸ ਕਰਕੇ ਮੈਂ ਉਹਨਾਂ ਤੋਂ ਘਬਰਾ ਗਿਆ ਅਤੇ ਫਿਰ ਮੈਂ ਆਪਣੇ ਅਧਿ ਅਧਿਆਪਕ ਵੱਲ ਝਾਕਿਆ ਤਾਂ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਅਤੇ ਮੈਂ ਆਪਣਾ ਗਾਉਣਾ ਸਟਾਰਟ ਕੀਤਾ ਅਤੇ ਮੈਂ ਇਹ ਮੇਰਾ ਐਕਸਪੀਰੀਅੰਸ ਗਾਉਣ ਦਾ ਪਹਿਲੀ ਵਾਰ ਬਹੁਤ ਹੀ ਮਾੜਾ ਰਿਹਾ ਕਿਉਂਕਿ ਮੈਂ ਵਾਰ ਵਾਰ ਰੁਕ ਜਾਂਦਾ ਸੀ ਅਤੇ ਲੋਕਾਂ ਤੋਂ ਡਰ ਜਾਂਦਾ ਸੀਗਾ ਘਬਰਾਉਣਾ ਬਹੁਤ ਹੀ ਲਾਜ਼ਮੀ ਹੁੰਦਾ ਹੈ ਕਿਉਂ ਅਕਸਰ ਘਬਰਾ ਹੀ ਜਾਂਦਾ ਹੈ ਲੋਕਾਂ ਨੂੰ ਦੇਖ ਕੇ ਬੰਦਾ ਘਬਰਾਹਟ ਮਹਿਸੂਸ ਕਰਨ ਲੱਗ ਜਾਂਦਾ ਹੈ